ਪਿੰਡਾਂ ਵਿੱਚ ਬਹੁਤ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਨਾਂ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਮੈਂ ਅੱਜ ਦੱਸਣਾ ਚਾਹੁੰਦਾ ਕਿ ਖੋ ਖੋ ਬੰਟੇ ਪਿੱਠੂ ਇਹੋ ਜੀ ਵਧੇਰੀਆਂ ਗੇਮਾਂ ਸਾਡੇ ਪਿੰਡਾਂ ਵਿੱਚ ਖੇਡੀਆਂ ਜਾਂਦੀਆਂ ਹਨ ਅਤੇ ਮੈਂ ਥੋਨੂੰ ਖੋ ਖੋ ਬਾਰੇ ਦੱਸਣਾ ਚਾਹੁੰਦਾ ਖੋ ਖੋ ਗੇਮ ਵਿੱਚ ਬਾਰਾਂ ਬੰਦੇ ਹੁੰਦੇ ਹਨ ਛੇ ਇੱਕ ਟੀਮ ਦੇ ਅਤੇ ਛੇ ਦੂਜੀ ਟੀਮ ਦੇ ਇਹਨਾਂ ਵਿੱਚ ਇੱਕ ਬੰਦੇ ਨੂੰ ਦੂਜੇ ਬੰਦੇ ਦੇ ਮਗਰ ਭੱਜਣਾ ਹੁੰਦਾ ਹੈ ਉਸਨੂੰ ਹੱਥ ਲਗਾਣਾ ਹੁੰਦਾ ਹੈ ਅਤੇ ਇਹ ਗੇਮ ਜਿੱਤਣੀ ਹੁੰਦੀ ਹੈ